ਤੁਹਾਨੂੰ ਪਤਾ ਹੈ ਕਿ ਪਰਿਆਵਰਨ ਵਿੱਚ ਬਹੁਤ ਜਿਆਦਾ ਹੀ ਚੇਂਜ ਆ ਰਿਹਾ ਹੈ ਇਹ ਚੇਂਜ ਸਾਡੇ ਪਰਿਆਵਰਨ ਵਿੱਚ ਬਹੁਤ ਜਿਆਦਾ ਨੁਕਸਾਨਦਾਇਕ ਹੋ ਰਿਹਾ ਹੈ ਇਹਦੇ ਵਿੱਚ ਸਾਨੂੰ ਬਹੁਤ ਜਿਆਦਾ ਗਰਮੀ ਵੱਧ ਰਹੀ ਹੈ ਜ ਪੇੜ ਪੌਦਿਆਂ ਨੂੰ ਅੱਗ ਦੇ ਨਾਲ ਜੋੜ ਰਹੀ ਹੈ ਤੇ ਸਾਨੂੰ ਇਸ ਨਾਲ ਬਹੁਤ ਜਿਆਦਾ ਗਰਮੀ ਆ ਰਹੀ ਹੈ ਤੇ ਸਾਡਾ ਜਿਹੜਾ ਪ੍ਰਿਥਵੀ ਹੈਗੀ ਹ ਉਹ ਗਰਮੀ ਦੀ ਥਾਂ ਤੇ ਉੱਤੇ ਜਾ ਰਿਹਾ ਹੈ ਠੰਡ ਨੂੰ ਘਟਾ ਰਿਹਾ ਹੈ ਸਾਨੂੰ ਇਹਨੂੰ ਰੋਕਣ ਵਾਸਤੇ ਸਾ ਇਸਨੂੰ ਕਲਾਈਮੇਟ ਚੇਂਜਿਸ ਚੈਲੰਜਸ ਨੂੰ ਅਪਣਾਉਣਾ ਪੈਣਾ ਹੈ ਤੇ ਸਾਨੂੰ ਜਿਆਦਾ ਤੋਂ ਜਿਆਦਾ ਪੇੜ ਪੌਦੇ ਲਗਾਣੇ ਪੈਣੇ ਹਨ ਤੇ ਆਪਣੇ ਪਰਿਆਵਰਨ ਨੂੰ ਸੁਧਾਰ ਕੇ ਰੱਖਣਾ ਪੈਣਾ ਹੈ ਤੇ ਸਾਫ ਸੁਥਰਾ ਪਰਿਆਵਰਨ ਹੀ ਹੈਗਾ ਹੈ ਜੋ ਸਾਨੂੰ ਇਸ ਚੀਜ਼ ਲਈ ਪ੍ਰਸਾਰਿਤ ਕਰਦਾ ਹੈ ਇਹ ਜਿਹੜਾ ਪਰਿਆਵਾਰਨ ਨੂੰ ਅਸੀਂ ਹੀ ਲੋਕਾਂ ਨੇ ਖਰਾਬ ਕੀਤਾ ਹੈ ਤੇ ਇਹ ਲੋਕ ਆਪਾਂ ਹੀ ਹੈਗੇ ਜੋ ਇਹ ਪਰਿਆਵਰਨ ਨੂੰ ਠੀਕ ਕਰ ਸਕਦੇ ਹਾਂ ਸਾਨੂੰ ਜਿਆਦਾ ਤੋਂ ਜਿਆਦਾ ਆਪਣੇ ਕਾਰਾਂ ਨੂੰ ਮੋਟਰਸਾਈਕਲਾਂ ਨੂੰ ਘੱਟ ਚਲਾਣਾ ਚਾਹੀਦਾ ਹੈ ਤੇ ਪਬਲਿਕ ਟਰਾਂਸਪੋਰਟ ਨੂੰ ਅਪਣਾਉਣਾ ਚਾਹੀਦਾ ਹੈ ਜਿਸ ਕਰਕੇ ਹਰ ਇਨਸਾਨ ਅਪ ਪਰ ਪ੍ਰਕ੍ਰਿਤੀ ਵੱਲ ਕੁਛ ਨਾ ਕੁਛ ਯੋਗਦਾਨ ਕਰੇਗਾ ਤੇ ਸਾਡਾ ਪ੍ਰਕ੍ਰਿਤੀ ਔਸਤ ਜਿਆਦਾ ਵੀ ਵਧੀਆ ਹੋ ਜਾਊਗੀ ਤੇ ਜੋ ਕਲਾਈਮੇਟ ਚੇਂਜ ਹੈਗਾ ਹੈ ਉਹ ਘੱਟ ਜਾਊਗਾ ਇਨਵਾਇਰਮੈਂਟ ਇੰਪੈਕਟ ਵੀ ਬਹੁਤ ਜਿਆਦਾ ਵਧ ਰਿਹਾ ਹੈ ਜਿਸ ਕਰਕੇ ਲੋਕਾਂ ਨੂੰ ਬਹੁਤ ਸਾਰੀ ਸਕਿਨ ਦੀ ਬਿਮਾਰੀਆਂ ਹੋ ਰਹੀਆਂ ਹਨ ਤੇ ਕੈਂਸਰ ਦੇ ਨਾਲ ਨਾਲ ਪ੍ਰਸਾਹਿਤ ਹੋ ਰਹੇ ਹਨ ਇਸ ਕਰਕੇ ਸਾਨੂੰ ਆਪਣੇ ਵਾਤਾਵਰਣ ਨੂੰ ਸਹੀ ਰੱਖਣ ਵਾਸਤੇ ਪੇੜ ਪੌਦੇ ਉਗਾਣੇ ਚਾਹੀਦੇ ਹਨ ਤੇ ਘੱਟ ਤੋਂ ਘੱਟ ਵਾ ਵਾਹਨ ਦਾ ਯੂਜ ਕਰਨਾ ਚਾਹੀਦਾ ਹੈ